ਮੈਂ ਆਪਣੀ ਬੇਟੀ ਨੂੰ ਪੜ੍ਹਾਉਣਾ ਚਾਹੁੰਦੀ ਹਾਂ ਕਿਉਂਕਿ ਮੈਂ ਆਪ ਵੀ ਪੜ੍ਹੀ ਲਿਖੀ ਹਾਂ ਅਤੇ ਮੈਂ ਵੀ ਚਾਹੁੰਦੀ ਹਾਂ ਕਿ ਮੇਰਾ ਬੱਚਾ ਵੀ ਉਨਾਂ ਹੀ ਪੜ੍ਹੇ ਚਲੋ ਮੇਰੇ ਜਿੰਨਾਂ ਨਾ ਵੀ ਪੜ੍ਹ ਸਕੇ ਪਰ ਫਿਰ ਵੀ ਮੇਰੇ ਤੋਂ ਵੱਧ ਹੀ ਪੜ੍ਹੇ ਹਰ ਮਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਬੱਚੇ ਨੂੰ ਪੜ੍ਹਾਵੇ ਪਰ ਆ ਜਾਂਦੀ ਆ ਪ੍ਰੋਬਲਮ ਪੈਸੇ ਦੀ ਉਹਦੇ ਕਰਕੇ ਉਹਨਾਂ ਨੂੰ ਮੁਸ਼ਕਿਲ ਆਉਂਦੀ ਹੈ ਕਿ ਪੈਸਾ ਕਿੱਥੋਂ ਫਿਰ ਵੀ ਅਸੀਂ ਜਿਸ ਵੇਲੇ ਤੁਹਾਡੀ ਇੱਛਾ ਹੁੰਦੀ ਹੈ ਉਹ ਕਹਿੰਦੇ ਨਾ ਜਿੱਥੇ ਚਾਹ ਉੱਥੇ ਰਾਹ ਉੱਥੇ ਰਾਹ ਵੀ ਨਿਕਲਦੀ ਆ ਫਿਰ ਤੁਸੀਂ ਕਿਤੋਂ ਲੋਨ ਲੈ ਸਕਦੇ ਹੁਣ ਤਾਂ ਸੋਰਸਿਸ ਖੁੱਲ੍ਹੇ ਹੋਏ ਕਿਸੇ ਕੋਲ ਪੈਸੇ ਮੰਗ ਕੇ ਥੋੜ੍ਹੀ ਦੇਰ ਆਪਣਾ ਗੁਜ਼ਾਰਾ ਕਰਕੇ ਆਪਣੇ ਬੱਚੇ ਨੂੰ ਤੁਸੀਂ ਪੜ੍ਹਾ ਸਕਦੇ ਹੋ ਜੇ ਤੁਹਾਡੀ ਪੜ੍ਹਾਉਣ ਦੀ ਨੀਤ ਹੈਗੀ ਹੈ ਜੇ ਤੁਸੀਂ ਨਹੀਂ ਪੜ੍ਹਾਉਣਾ ਚਾਹੁੰਦੇ ਤਾਂ ਫਿਰ ਤਾਂ ਗੱਲ ਹੀ ਖ਼ਤਮ ਆ ਨਾ ਅਤੇ ਇਸ ਕਰਕੇ ਮੈਂ ਤਾਂ ਚਾਹੁੰਦੀ ਐਂ ਕਿ ਮੇਰਾ ਬੱਚਾ ਜ਼ਿਆਦਾ ਤੋਂ ਜ਼ਿਆਦਾ ਮੇਰੇ ਤੋਂ ਵੀ ਜ਼ਿਆਦਾ ਪੜ੍ਹੇ ਕਿਉਂਕਿ ਪੜ੍ਹਨ ਦੇ ਨਾਲ਼ ਇੱਕ ਤੁਹਾਡੀ ਸੋਚ ਬਦਲਦੀ ਹੈ ਇੱਕ ਤੁਹਾਡਾ

ਕਰੈਟੀਰੀਆ ਬਦਲਦਾ ਸੋਚਣ ਦਾ ਅਤੇ ਇੱਕ ਤੁਹਾਡੇ ਨਵੇਂ ਨਵੇਂ ਲਿੰਕਸ ਅੱਛੇ ਲੋਕਾਂ ਨਾਲ਼ ਹੁੰਦੇ ਜੇ ਤੁਸੀਂ ਪੜ੍ਹੇ ਲਿਖੇ ਹੋ ਤਾਂ ਤੁਸੀਂ ਪੜ੍ਹੇ ਲਿਖੇ ਲੋਕਾਂ ਨੂੰ ਹੀ ਪਸੰਦ ਕਰੋਗੇ ਰਹਿਣਾ ਅਤੇ ਉਹਨਾਂ ਦੀ ਸੋਚ ਤੁਹਾਡੇ ਨਾਲ਼ ਰਲੇਗੀ ਵੀ ਜਿਹਨਾਂ ਨਾਲ਼ ਨਹੀਂ ਰਲਦੀ ਉਹਨਾਂ ਨਾਲ਼ ਤੁਸੀਂ ਬੈਠਣਾ ਵੀ ਨਹੀਂ ਪਸੰਦ ਕਰਦੇ ਪੜ੍ਹਨ ਨਾਲ਼ ਇੱਕ ਤਾਂ ਬਰੋਡ ਮਾਇੰਡਿਡ ਹੁੰਦੇ ਹੋ ਤੁਸੀਂ ਪੜ੍ਹਨ ਨਾਲ਼ ਬੜੀਆਂ ਪ੍ਰੋਬਲਮ ਖ਼ਤਮ ਹੁੰਦੀਆਂ ਵਾ ਕਿਉਂਕਿ ਤੁਸੀਂ ਆਪ ਕਮਾਉਣ ਦੇ ਯੋਗ ਹੁੰਦੇ ਹੋ ਅਤੇ ਜਿਸ ਤਰ੍ਹਾਂ ਤੁਸੀਂ ਆਪ ਕਮਾਉਣ ਦੇ ਯੋਗ ਹੋ ਤੁਸੀਂ ਕਿਸੇ 'ਤੇ ਬੋਝ ਨਹੀਂ ਬਣੋਗੇ ਅਤੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਮੇਰੀ ਬੇਟੀ ਵੀ ਕਿਸੇ 'ਤੇ ਵੀ ਬੋਝ ਬਣੇ ਉਹ ਆਪਣਾ ਕਮਾਵੇ ਆਪਣੀ ਮਰਜ਼ੀ ਦੀ ਜ਼ਿੰਦਗੀ ਜੀਵੇ ਇੱਕ ਤਾਂ ਉਹ ਇਸ ਤਰ੍ਹਾਂ ਹੀ ਹੋ ਸਕਦਾ ਜੇ ਉਹ ਪੜ੍ਹੇ ਲਿਖੇਗੀ ਫਿਰ ਹੀ ਉਹਦੀ ਸੋਚ ਡਿਵੈਲਪ ਹੋਏਗੀ ਨਹੀਂ ਤਾਂ ਉਹ ਘਰ ਦਾ ਓਹ ਜੇ ਕਹਿੰਦੇ ਨਾ ਘਰ ਦਾ ਜੋਗੀ ਜੋਗੜਾ ਵਾਲਾ ਉਹ ਵਾਲਾ ਉਹ ਘਰ ਓ ਡੱਡੂ ਬਣ ਕੇ ਰਹਿ ਜੇਗੀ ਘਰ ਦਾ ਡੱਡੂ ਇਸ ਕਰਕੇ ਮੈਂ ਚਾਹੁੰਦੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੜ੍ਹੇ